ਮੈਂ ਸਿਮਰਨ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਅਤੇ ਮੈਨੂੰ ਬੁਣਾਈ ਦਾ ਬਹੁਤ ਸ਼ੌਂਕ ਸੀ ਮੈਂ ਬਚਪਨ ਤੋਂ ਹੀ ਮੈਂ ਬੁਣਾਈ ਕਰਦੀ ਆ ਰਹੀ ਹਾਂ ਅਤੇ ਬਚਪਨ 'ਚ ਵੀ ਮੈਂ ਜਦੋਂ ਛੋਟੀ ਸੀਗੀ ਅਤੇ ਸਿਲਾਈਆਂ ਲੈ ਕੇ ਮੈਂ ਬੁਣਾਈ ਕਰਦੀ ਸੀਗੀ ਛੋਟੇ ਛੋਟੇ ਸਵੈਟਰ ਬਣਾਉਂਦੀ ਸੀ ਖਿਡੌਣਿਆਂ ਦੇ ਫਿਰ ਬਾਅਦ 'ਚ ਜਦੋਂ ਮੈਂ ਵੱਡੀ ਹੋਈ ਤਾਂ ਫਿਰ ਵੀ ਬਣਾਉਣੇ ਸ਼ੁਰੂ ਕੀਤੇ ਫਿਰ ਚਲੋ ਮੇਰਾ ਵਿਆਹ ਹੋ ਗਿਆ ਫਿਰ ਮੈਂ ਆਪਣੇ ਬੱਚਿਆਂ ਦੇ ਬਣਾਉਂਦੀ ਸੀ ਸਵੈਟਰ ਰੰਗ ਬਿਰੰਗੇ ਕਲਰਾਂ ਦੇ ਨਾਲ ਵਨ ਸਵੰਨੇ ਇਹਦੇ ਵਿੱਚ ਮੈਨੂੰ ਬੁਣਾਈ ਕਰਨ ਦੇ ਵਿੱਚ ਮੈਨੂੰ ਜਿਹੜੀ ਤਿੰਨ ਤਰ੍ਹਾਂ ਦੀ ਉੱਨ ਹੁੰਦੀ ਉਹਦੇ ਚ ਦਿੱਕਤ ਆਉਂਦੀ ਹੈ ਬੁਣਾਈ ਕਰਨ 'ਚ ਵੈਸੇ ਤਾਂ ਵੰਨ ਸੁਵੰਨੇ ਡਿਜ਼ਾਇਨ ਬਣਾ ਕੇ ਵੰਨ ਸਵੰਨੀ ਉੱਨਤੀ ਮੈਂ ਬਹੁਤ ਬਣਾਉਂਦੀ ਰਹੀ ਹਾਂ ਸਵੇਟਰ ਹੁਣ ਤੱਕ ਵੀ ਬਣਾਈ ਦੇ ਆ ਅਤੇ ਮੈਂ ਆਪਣੇ ਹਸਬੈਂਡ ਦੇ ਵੀ ਬਣਾਏ ਆ ਬਾਹਰ ਮੇਰੀਆਂ ਫਰੈਂਡਸ ਵੀ ਮੈਨੂੰ ਕਈ ਵਾਰੀ ਆਰਡਰ ਦਿੰਦੀਆਂ ਸੀ ਮੈਂ ਤਾਂ ਵੀ ਬਣਾਉਂਦੀ ਸੀਗੀ ਵੰਨ ਸੁਵੰਨੀਆਂ ਉੱਨਤੀਆਂ ਪਾ ਕੇ ਇਹਦੇ 'ਚ ਐਕਸਪੀਰੀਅੰਸ ਤਾਂ ਮੇਰਾ ਵਧੀਆ ਹੀ ਲਾਭਦਾਇਕ ਹੀ ਰਿਹਾ ਆ ਕੋਈ ਨੁਕਸਾਨ ਵਾਲਾ ਤਾਂ ਨਹੀਂ ਰਿਹਾ ਅਤੇ ਵਧੀਆ ਆ ਬੁਣਾਈ ਕਰਨਾ ਮੇਰਾ ਸ਼ੌਂਕ ਵੀ ਆ ਅਤੇ ਹੁਣ ਵੀ ਖਰੀਦੀ ਆ ਬੁਣਾਈ ਉੱਨਤੀ ਪਾ ਲਈ ਦੀ ਆ ਵੰਨ ਸੁਵੰਨੇ ਆ ਬੱਚਿਆਂ ਵਾਸਤੇ ਬਣਾ ਲਈਦੇ ਨੇ ਸਵੈਟਰ ਕੋਟੀਆਂ ਜੋ ਵੀ ਹੈ ਡਰੈਸਾਂ ਪੂਰੀਆਂ ਅੱਜ ਕੱਲ੍ਹ ਤਾਂ ਚੱਲਦੀਆਂ ਬੱਚਿਆਂ ਦੀਆਂ ਰੰਗ ਬਰੰਗੇ ਕਲਰਾਂ ਵਾਲੀਆਂ ਬਣਾ ਲਈ ਦੀਆਂ ਨੇ ਅਤੇ ਜਿਹੜੀ ਤਿੰਨ ਤਰ੍ਹਾਂ ਦੀ ਲਾਈਕ ਤਿੰਨ ਤਾਂ ਵਾਲੀ ਹੁੰਦੀ ਆ ਉਹਦੇ 'ਚ ਥੋੜ੍ਹੀ ਔਖਿਆਈ ਹੁੰਦੀ ਆ ਉਹ ਬਣਦੀ ਤਾਂ ਵਧੀਆ ਆ ਪਰ ਬਣਾਉਣ ਲੱਗਿਆਂ ਥੋੜ੍ਹੀ ਮੁਸ਼ਕਿਲ ਆਉਂਦੀ ਆ ਪਰ ਬਾਅਦ 'ਚ ਜਦੋਂ ਉਹਨੂੰ ਬਣਾ ਲਈਏ ਉਹ ਵਧੀਆ ਰਹਿੰਦੀ ਆ ਨਾ ਉਹਦੇ 'ਤੇ ਬੁਰ ਆਉਂਦੀ ਆ ਅਤੇ ਉਹ ਕਲਰ ਵੀ ਉਹ 'ਚ ਬੜੇ ਸੋਹਣੇ ਸੋਹਣੇ ਮਿਲ ਜਾਂਦੇ ਨੇ ਅਤੇ ਮੇਰਾ ਤਾਂ ਇਹੀ ਐਕਸਪੀਰੀਅੰਸ ਰਿਹਾ ਆ ਕਿ ਖੁਦ ਹੱਥ ਨਾਲ ਬਣਾ ਕੇ ਬੁਣਾਈ ਕਰਕੇ ਅਤੇ ਕੱਪੜੇ ਪਾਉਣ 'ਚ ਵਧੀਆ ਰਹਿੰਦਾ ਆ ਅਤੇ ਸਹੀ ਵੀ ਰਹਿੰਦੇ ਨੇ ਉਹ ਹੰਢ ਦੇ ਵੀ ਜ਼ਿਆਦਾ ਨੇ ਅਤੇ ਸੋਹਣੇ ਵੀ ਲੱਗਦੇ ਨੇ ਪਰ ਬਾਹਰੋ ਰੈਡੀਮੇਟ ਲੈਣ ਨਾਲੋਂ ਤਾਂ ਮੈਨੂੰ ਤਾਂ ਉਹ ਵਧੀਆ ਲੱਗਦੇ ਨੇ ਲਾਈਵ ਦਾ ਕੀ ਐਕਸਪਲੇਨਸ ਰਿਹਾ ਆ ਕੋਈ ਨੁਕਸਾਨ ਵਾਲਾ ਤਾਂ ਨਹੀਂ ਰਿਹਾ